ਵਿਕਾਸਸ਼ੀਲ ਸੰਸਾਰ ਬਾਰੇ ਮੇਰੀ ਇਹ ਰਾਏ ਹੈ ਕਿ ਵਿਗਿਆਨ ਨੇ ਬਹੁਤ ਸਾਰੀ ਤਰੱਕੀ ਕਰ ਲਈ ਹੈ ਪਹਿਲਾਂ ਮਕਾਨ ਵਗੈਰਾ ਪੱਕੇ ਹੁੰਦੇ ਸੀ ਹੁਣ ਸੜਕਾਂ ਪੱਕੀਆਂ ਹੋ ਗਈਆਂ ਹਨ ਅਤੇ ਮਕਾਨ ਜੋ ਹੈ ਉਹ ਵੀ ਇੱਟਾਂ ਪੱਥਰਾਂ ਵਾਲੇ ਹੋ ਗਏ ਹਨ ਬਹੁਤ ਸਾਰੇ ਵਹੀਕਲਸ ਜੋ ਹੈ ਬਹੁਤ ਸਾਰੇ ਵਾਹਨ ਜੋ ਹੈ ਉਹ ਆ ਗਏ ਹਨ ਜਿਨ੍ਹਾਂ ਦੇ ਨਾਲ ਇੱਕ ਦੂਜ ਇੱਕ ਥਾਂ ਤੋਂ ਦੂਜ ਦੂਜੀ ਥਾਂ ਜਾਣਾ ਬਹੁਤ ਆਸਾਨ ਹੋ ਚੁੱਕਿਆ ਹੈ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਮਸ਼ੀਨਾਂ ਆ ਚੁੱਕੀਆਂ ਹਨ ਮਾਈਕਰੋਵੇਵ ਮਿਕਸੀ ਵਾਸ਼ਿੰਗ ਮਸ਼ੀਨ ਜਿਨ੍ਹਾਂ ਦੇ ਨਾਲ ਕੰਮ ਕਰਨਾ ਆਸਾਨ ਹੋ ਗਿਆ ਹੈ ਸਾਡੇ ਵਪਾਰ ਜਾਂ ਆਂ ਕੰਮ ਔਫਿਸ ਵਗੈਰਾ ਦੇ ਵਿੱਚ ਵੀ ਕੰਪਿਊਟਰ ਆ ਚੁੱਕੇ ਹਨ ਜਿਨ੍ਹਾਂ ਦੇ ਜਿ ਜਿਹੜੇ ਕਿ ਬਹੁਤ ਕੰਪਿਊਟਰ ਦੇ ਆਉਣ ਨਾਲ ਵੀ ਬਹੁਤ ਸਾਰਾ ਕੰਮ ਜੋ ਹੈ ਉਹ ਈਜ਼ੀ ਹੋ ਗਿਆ ਹੈ ਸਾਨੂੰ ਵਾਰ ਵਾਰ ਕੋਈ ਵੀ ਕੰਮ ਦੁਬਾਰਾ ਦੁਬਾਰਾ ਨਹੀਂ ਕਰਨਾ ਪੈਂਦਾ ਅਸੀ ਕੰਪਿਊਟਰ ਦੇ ਵਿੱਚ ਆਪਣੇ ਕੰਮ ਨੂੰ ਸੇਵ ਕਰਕੇ ਰੱਖ ਸਕਦੇ ਹਾਂ ਉਸ ਤੋਂ ਇਲਾਵਾ ਬਿਜਲੀ ਜੋ ਹੈ ਉਹਦੇ ਆਉਣ ਨਾਲ ਪੱਖੇ ਏ ਸੀ ਲਾਈਟਾਂ ਆ ਗਈਆਂ ਹਨ ਜਿਨ੍ਹਾਂ ਦੇ ਨਾਲ ਕਿ ਕੰਮ ਹੋਰ ਜ਼ਿਆਦਾ ਆਸਾਨ ਹੋ ਚੁੱਕਿਆ ਹੈ ਉਸ ਤੋਂ ਇਲਾਵਾ ਇਹ ਸਾ ਇਹ ਸਾਰਾ ਜੋ ਹੈ ਇਸ ਇਸਦੇ ਨਾਲ ਵਿਗਿਆਨ ਨੇ ਬਹੁਤ ਸਾਰੀ ਤਰੱਕੀ ਕਰ ਲਈ ਹੈ ਜਿਸ ਦੇ ਨਾਲ ਕਿ ਸਾਡੇ ਬਹੁਤ ਜਿੰਨੇ ਵੀ ਕੰਮ ਹਨ ਉਹ ਬਹੁਤ ਆਸਾਨ ਹੋ ਚੁੱਕੇ ਹਨ ਸਾਨੂੰ ਹੁਣ ਕੋਈ ਵੀ ਕੰਮ ਜੋ ਹੈ ਉਸ ਦੇ ਵਿੱਚ ਮੁਸ਼ਕਿਲ ਨਹੀਂ ਆਉਂਦੀ ਖੇਤਾਂ ਦੇ ਵਿੱਚ ਵੀ ਖੇਤੀ ਦੇ ਵਿੱਚ ਵੀ ਬਹੁਤ ਸਾਰੀਆਂ ਮਸ਼ੀਨਾਂ ਆ ਚੁੱਕੀਆਂ ਹਨ ਬਹੁਤ ਸਾਰੇ ਸੰਦ ਆ ਚੁੱਕੇ ਹਨ ਜਿਹੜੀ ਖੇਤੀ ਪਹਿਲਾਂ ਬਲਦਾਂ ਨਾਲ ਹੁੰਦੀ ਸੀ ਉਹਦੀ ਜਗ੍ਹਾ ਹੁਣ ਉਹ ਬਹੁਤ ਸਾਰੇ ਸੰਦ ਜੋ ਹੈ ਉਹਨਾਂ ਉਹਨਾਂ ਨੇ ਬਲਦਾਂ ਨੂੰ ਰਿਪਲੇਸ ਕਰ ਦਿੱਤਾ ਹੈ ਉਸ ਦੇ ਨਾਲ ਖੇਤੀ ਮਤਲਬ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਆਸਾ ਆਸਾਨੀ ਨਾਲ ਕਰ ਸਕਦੇ ਹਾਂ ਇਸ ਲਈ ਵਿਗਿਆਨ ਦੁਨੀਆ ਬਦਲ ਚੁੱਕੀ ਅ ਵਿਕਾਸ ਦੁਨੀਆ ਜੋ ਹੈ ਉਹ ਬਦਲ ਚੁੱਕੀ ਹੈ ਅਤੇ ਜੋ ਵਿਗਿਆਨਿਕ ਯੁੱਗ ਹੈ ਉਸਨੇ ਪੁਰਾਣੀਆਂ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦਿੱਤਾ ਹੈ